ਮੈਂ ਦੁਕਾਨਦਾਰ ਹਾਂ ਅਤੇ ਨਾਲ ਦੀ ਨਾਲ ਬਾਰ੍ਹਵੀਂ ਜਮਾਤ ਵਿੱਚ ਪੜ੍ਹਦਾ ਹਾਂ ਮੈਂ ਆਪਣੇ ਬਿਜ਼ਨਸ ਨੂੰ ਵੱਡੇ ਪੱਧਰ 'ਤੇ ਕਰਨਾ ਚਾਹੁੰਦਾ ਹਾਂ ਤਾਂ ਜੋ ਮੈਂ ਲੋਕਾਂ ਨੂੰ ਇੱਥੇ ਰਹਿ ਕੇ ਇਮਪਲੋਇਮੈਂਟ ਦੇ ਸਕਾਂ ਮੈਂ ਬਾਹਰ ਜਾਣ ਨਾਲੋਂ ਚੰਗਾ ਇੱਥੇ ਆਪਣਾ ਬਿਜ਼ਨਸ ਚਲਾਉਣਾ ਚਾਹੁੰਦਾ ਹਾਂ ਅਤੇ ਹੋਰ ਲੋਕਾਂ ਨੂੰ ਵੀ ਇਮਪਲੋਇਮੈਂਟ ਦੇਣਾ ਚਾਹੁੰਦਾ ਹਾਂ ਮੇਰੀ ਸੋਚ ਇਹ ਹੈ ਕਿ ਸਾਨੂੰ ਆਪਣੀ ਧਰਤੀ ਛੱਡ ਕੇ ਬਾਹਰ ਨਹੀਂ ਜਾਣਾ ਚਾਹੀਦਾ ਸਗੋਂ ਜਿੱਥੇ ਰਹਿੰਦੇ ਹਾਂ ਉਸ ਨੂੰ ਚੰਗਾ ਬਣਾਉਣਾ ਚਾਹੀਦਾ ਹੈ ਕਿਉਂਕਿ ਜਿੱਥੇ ਅਸੀਂ ਜੰਮੇ ਪਲੇ ਉਹਨੂੰ ਛੱਡ ਕੇ ਜਾਣਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ ਅਤੇ ਇੱਥੇ ਅਨਇਮਪਲੋਇਮੈਂਟ ਵੀ ਬਹੁਤ ਹੈ ਇਸ ਲਈ ਮੈਂ ਆਪਣੇ ਬਿਜ਼ਨਸ ਨੂੰ ਵੱਡੇ ਪੱਧਰ 'ਤੇ ਕਰਾਂਗਾ ਅਤੇ ਨਾਲ ਹੀ ਨਾਲ ਹੋਰ ਵੀ ਬੰਦੇ ਰੱਖਾਂਗਾ ਜੋ ਮੇਰੀ ਟੀਮ ਦਾ ਹਿੱਸਾ ਬਣਨਗੇ ਅਤੇ ਮੈਂ ਉਹਨਾਂ ਨੂੰ ਚੰਗੀਆਂ ਤਨਖਾਹਾਂ ਵੀ ਦੇਵਾਂਗਾ ਅਤੇ ਇੰਕਰੀਮੈਂਟ ਵੀ ਦਵਾਂਗਾ ਮੈਂ ਆਪਣੀ ਕੰਪਨੀ ਦੀ ਗੁੱਡਵਿਲ ਵੀ ਬਹੁਤ ਉੱਪਰ ਤੱਕ ਖੜ੍ਹਾਂਗਾ ਅਤੇ ਮੈਂ ਇੱਕ ਚੰਗਾ ਬਿਜ਼ਨਸਮੈਨ ਬਣਾਂਗਾ ਨਾਲ ਹੀ ਨਾਲ ਆਪਣੀ ਪੜ੍ਹਾਈ ਵੀ ਕੰਪਲੀਟ ਕਰਾਂਗਾ